ਪਾਣੀ ਨੂੰ ਫਿਲਟਰ ਕਰਨ ਲਈ ਅਤੇ ਸ਼ੁੱਧ ਕਰਨ ਲਈ ਆਪਾਂ ਆਪਣੇ ਘਰ ਵਿੱਚ ਫਿਲਟਰ ਨਾਮਕ ਇਲੈਕਟਰੋਨਿਕ ਮਸ਼ੀਨ ਦਾ ਪ੍ਰਯੋਗ ਕਰਦੇ ਹਨ ਸਾਡੇ ਘਰਾਂ ਵਿੱਚ ਬਹੁਤ ਸਾਰੇ ਘਰੇਲੂ ਇਲਾਜ ਹਨ ਪਾਣੀ ਨੂੰ ਫਿਲਟਰ ਕਰਨ ਲਈ ਜਿਵੇਂ ਆਪਾਂ ਪਾਣੀ ਨੂੰ ਉਬਾਲ ਕੇ ਪੀ ਸਕਦੇ ਹਨ ਉਹ ਅੱਜ ਕੱਲ੍ਹ ਅਤੇ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਬਹੁਤ ਹੀ ਘਰੇਲੂ ਇਲਾਜ ਹੈ ਪਾਣੀ ਨੂੰ ਗੈਸ 'ਤੇ ਰੱਖਣਾ ਅਤੇ ਉਹਨੂੰ ਉਬਾਲ ਕੇ ਉਹਨੂੰ ਪੀ ਲੈਣਾ ਇਹ ਪਾਣੀ ਨੂੰ ਫਿਲਟਰ ਕਰਨ ਦਾ ਬਹੁਤ ਹੀ ਵਧੀਆ ਅਤੇ ਘਰੇਲੂ ਇਲਾਜ ਹਨ ਪੁਰਾਣਿਕ ਸਮੇਂ ਤੋਂ ਇਹ ਚੱਲਦਾ ਆ ਰਿਹਾ ਹੈ ਪਾਣੀ ਫਿਲਟਰ ਪਹਿਲੇ ਸਮੇਂ ਵਿੱਚ ਫਿਲਟਰ ਨਹੀਂ ਸੀ ਆਉਂਦੇ ਜਿਹੜੇ ਇਲੈਕਟਰੋਨਿਕ ਹੁੰਦੇ ਨੇ ਲੇਕਿਨ ਪੁਰਾਣੇ ਸਮੇਂ ਵਿੱਚ ਪਹਿਲਾਂ ਪਾਣੀ ਨੂੰ ਉਬਾਲ ਕੇ ਹੀ ਫਿਲਟਰ ਕੀਤਾ ਜਾਂਦਾ ਸੀ ਅਤੇ ਉਹ ਹੀ ਸਾਰੇ ਲੋਕ ਪੀਂਦੇ ਸੀ ਬਟ ਹੁਣ ਤਾਂ ਬਹੁਤ ਸਾਰੇ ਇਲੈਕਟਰੋਨਿਕਸ ਮਸ਼ੀਨਸ ਆ ਗਈਆਂ ਹਨ ਜੋ ਪਾਣੀ ਨੂੰ ਫਿਲਟਰ ਕਰਦੀਆਂ ਹਨ ਲੇਕਿਨ ਅਜੇ ਵੀ ਬਹੁਤ ਸਾਰੇ ਘਰ ਇੱਦਾਂ ਦੇ ਹਨ ਜਿਹੜੇ ਪਾਣੀ ਨੂੰ ਉਬਾਲ ਕੇ ਹੀ ਪੀਦੇ ਹਨ ਸਗੋਂ ਫਿਲਟਰ ਵੀ ਜਿਹੜੇ ਇਲੈਕਟਰੋਨਿਕ ਹਨ ਉਹ ਵੀ ਕਈ ਜਗ ਕਈ ਜਗ੍ਹਾ ਆਪਣਾ ਸ਼ੁੱਧੀਕਰਨ ਨਹੀਂ ਦਿਖਾਉਂਦੇ ਤਾਂ ਡਾਕਟਰ ਵੀ ਇਹ ਕਹਿੰਦੇ ਹਨ ਕਿ ਤੁਸੀਂ ਆਪਣੇ ਪਾਣੀ ਨੂੰ ਪਹਿਲਾਂ ਉਬਾਲੋ ਅਤੇ ਫਿਰ ਉਹਨੂੰ ਪੀਓ ਤਾਂ ਕਿ ਉਹ ਤਾਹਨੂੰ ਵਧੀਆ ਹੀ ਰਿਜਲਟ ਦੱਸਣ ਤਾਂ ਸਾਨੂੰ ਘਰੇਲੂ ਇਲਾਜ ਫਿਲਟਰ ਦਾ ਇਹ ਹੀ ਹਨ ਕਿ ਸਾਨੂੰ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ